ਵਿਆਵਾਂ ਵਰਗੇ ਵੱਡੇ ਸਮਰੋਹਾ ਦੌ ਸਮਾਰੋਹਾਂ ਦੌਰਾਨ ਵੱਡੀ ਮਾਤਰਾ ਵਿੱਚ ਪਾਣੀ ਦਾ ਪ੍ਰਬੰਧ ਕਰਨ ਲਈ ਅਸੀਂ ਪਹਿਲੇ ਟਰਮ ਪ ਪਾਣੀ ਦੇ ਵੱਡੇ ਟੈਂਕਰ ਕਲ ਕਾਰਪੋਰੇਸ਼ਨ ਵਾਲੇ ਟੈਂਕਰ ਮੰਗਵਾਉਂਦੇ ਹਾਂ ਅਤੇ ਉਹਦੇ ਨਾਲ ਭਾਂਡੇ ਧੋਣ ਹੋਰ ਇਹੀ ਵਰਤਣ ਵਿੱਚ ਕੀਤਾ ਜਾਂਦਾ ਹੈ ਅਤੇ ਪਾਣੀ ਪਿਆਉਣ ਵਾਸਤੇ ਛੋਟੀਆਂ ਬੋਤਲਾਂ ਦਾ ਇੰਤਜ਼ਾਮ ਕੀਤਾ ਜਾਂਦਾ ਹੈ ਕਿਉਂਕਿ ਪਾਣੀ ਦੀ ਵੇਸਟੇਜ਼ ਨਾ ਹੋਵੇ ਪਾਣੀ ਦੀ ਮਾਤਰਾ ਘੱਟੋ ਘੱਟ ਹੋਵੇ ਪਾਣੀ ਛੋਟੀ ਬੋਤਲ 'ਚ ਹਰ ਕੋਈ ਇੱਕ ਬੋਤਲ ਪੀ ਸਕਦਾ ਹੈ ਵੱਡੀ ਬੋਤਲ ਲਈ ਹਰ ਕੋਈ ਵੱਡੀ ਬੋਤਲ ਲੈ ਕੇ ਪੂਰੀ ਬੋਤਲ ਨਹੀਂ ਪੀਵੇਗਾ ਅਤੇ ਅੱਧੀ ਬੋਤਲ ਖਰਾਬ ਕਰੇਗਾ ਇਸ ਲਈ ਅਸੀਂ ਛੋਟੀਆਂ ਛੋਟੀਆਂ ਬੋਤਲਾਂ ਹੀ ਜਾਂ ਛੋਟੇ ਗਿਲਾਸ ਵਰਤੋਂ ਵਿੱਚ ਲਿਆਉਂਦੇ ਹਾਂ ਤਾਂ ਕਿ ਪਾਣੀ ਦੀ ਬੱਚਤ ਕੀਤੀ ਜਾਵੇ ਵਿਆਹਵਾਂ ਵਰਗੇ ਵੱਡੇ ਸਮਰਾ ਸਮਾਰੋਹਾਂ ਵਿੱਚ ਪਾਣੀ ਦੀ ਮਾ ਮਾ ਪਾਣੀ ਦੀ ਬੱਚਤ ਕਰਨ ਦੀ ਬਹੁਤ ਜਰੂਰਤ ਹੁੰਦੀ ਹੈ ਪਾਣੀ ਨੂੰ ਬਚਾਉਣ ਵਾਸਤੇ ਸਾਨੂੰ ਅਤੇ ਇਸੇ ਲਈ ਹਰ ਤਰ੍ਹਾਂ ਦਾ ਇੰਤਜ਼ਾਮ ਕਰਨਾ ਪੈਂਦਾ ਹੈ ਪਾਣੀ ਦੇ ਟੈਂਕਰ ਵੀ ਮਹਿੰਗੇ ਪੈਂਦੇ ਹਨ ਕਿਉਂਕਿ ਉਹਨਾਂ ਦਾ ਪਾਣੀ ਵੇਸਟ ਹੋ ਸਕਦਾ ਹੈ ਲੇ ਪਰ ਜਿਹੜਾ ਪਾਣੀ ਗਲਾਸਾਂ ਵਿੱਚ ਗਲਾਸਾਂ ਵਿੱਚ ਆਏਗਾ ਉਹ ਮਿਣਤੀ ਦੇ ਹਿਸਾਬ ਨਾਲ ਹੀ ਹੋਏਗਾ ਇੱਕ ਇੱਕ ਬੰਦੇ ਨੂੰ ਇੱਕ ਗਲਾਸ ਦਿੱਤਾ ਜਾਵੇਗਾ ਉਹ ਪੀ ਪਾਣੀ ਇੰਨੀ ਕੁ ਮਾਤਰਾ ਹੁੰਦੀ ਹੈ ਕਿ ਪਾਣੀ ਪੀਤੀ 'ਚ ਪੀਤਾ ਜਾ ਸਕਦਾ ਹੈ ਧੰਨਵਾਦ